ਮੇਰੀਆਂ ਮਨ ਪਸੰਦ ਬਾਈਕਸ ਹਾਰਲੇ ਡਵਿਡਜਨ ਅਤੇ ਰੋਇਲ ਇਨਫੀਡਸ ਹਨ ਜਿਹਨਾਂ ਵਿੱਚੋਂ ਰੋਇਲ ਇਫੀਲਡ ਥਰੀ ਫਾਈਵ ਜ਼ੀਰੋ ਅਤੇ ਰੋਇਲ ਐਨਫੀਲਡ ਕਲਾਸਿਕ ਬਾਈਕਸ ਮੇਰੇ ਕੋਲ ਹਨ ਅਤੇ ਮੇਰੀ ਡਰੀਮ ਬਾਈਕ ਹਾਰਲੇ ਡ ਡਵਿਡਜ਼ਨ ਹੈ ਅਤੇ ਬਾਈਕਿੰਗ ਯਾਤਰਾਵਾਂ ਲਈ ਸਭ ਤੋਂ ਬਿਹਤਰ ਅਤੇ ਅਰਾਮਦਾਇਕ ਬਾਈਕਸ ਜਿਹਨਾਂ ਵਿੱਚੋਂ ਕਿ ਬੁਲੇਟ ਥਰੀ ਫਾਈਵ ਜ਼ੀਰੋ ਅਤੇ ਬੁਲੇਟ ਕਲਾਸਿਕ ਰੋਇਲ ਇਨਫੀਡ ਹਨ ਇਹ ਇਹ ਸਭ ਤੋਂ ਆਰਾਮਦਾਇਕ ਬਾਈਕਸ ਮੰਨੀਆਂ ਜਾਂਦੀਆਂ ਹਨ ਧੰਨਵਾਦ